ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ

ਓਕੇ ਅੱਛਾ ਜੀ ਓਕੇ ਅੱਛਾ ਅੱਛਾ ਅੱਛਾ ਨਹੀਂ ਉਹ ਨਾ ਪ ਆਪਣਾ ਮਤਲਬ ਐਕਚੁਲੀ ਮੈਨੂੰ ਕੰਮ ਪੈ ਗਿਆ ਮੈਂ ਵੀ ਨਹੀਂ ਧਿਆਨ ਦੇ ਸਕਿਆ ਅਤੇ ਮੁੰਡੇ ਨੇ ਹੀ ਕਰਿਆ ਸੀ ਕੰਮ ਉਹ ਅਤੇ ਚਲੋ ਇਹ ਤਾਂ ਕੋਈ ਐਡੀ ਇਸੂ ਵਾਲੀ ਗੱਲ ਨਹੀਂ ਆਪਾਂ ਤੁਸੀਂ ਲਿਆਇਉ ਆਪਾਂ ਉਹਨੂੰ ਕਰ ਲਵਾਂਗੇ ਸੈਟਿੰਗ ਜਿਵੇਂ ਵੀ ਹੋਈ ਉਹਦੀ ਹਾਂ ਦੁਬਾਰਾ ਫਿਰ ਹਾਂਜੀ ਇਹ ਕਿੰਨੀ ਤਰੀਕ ਕਿੰਨੀ ਤਰੀਕ ਦਾ ਸੀ ਆਪਣਾ ਪ੍ਰੋਗਰਾਮ ਅੱਛਾ ਅੱਛਾ ਅੱਛਾ ਠੀਕ ਹੈ ਨਹੀਂ ਐਡੀ ਕੋਈ ਮਸਲੇ ਦੀ ਗੱਲ ਨਹੀਂ ਤੁਸੀਂ ਲਿਆਓ ਆਪਾਂ ਜਿੰਨਾ ਵੀ ਹੋ ਸਕਿਆ ਆਪਾਂ ਉਹਨੂੰ ਸੈਟਿੰਗ ਕਰ ਦਿਆਂਗੇ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਆਪਾਂ ਕੋਈ ਗੱਲ ਨਹੀਂ ਨਹੀਂ ਵਧੀਆ ਹਾਂ ਹਾਂ ਉਹ ਆਪਾਂ ਸਲੈਕਟ ਕਰਕੇ ਉਹਨੂੰ ਕੱਢ ਦਿਆਂਗੇ ਅਤੇ ਬਾਕੀ ਪਈਆਂ ਸਾਰੀਆਂ ਆਪਣੇ ਕੋਲ ਪੈਨ ਡਰਾਈਵ 'ਚ ਹੀ ਹਾਂਜੀ ਹਾਂਜੀ ਠੀਕ ਠੀਕ ਠੀਕ ਨਾ ਨਾ ਹਾਂਜੀ ਹਾਂਜੀ ਹਾਂਜੀ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ ਹਾਂਜੀ ਓਕੇ ਜੀ